ਹਾਂਜੀ ਸਾਡੇ ਖੇਤਰ ਸੈਲਾਨੀ ਅਕਰਸ਼ਣ ਅਤੇ ਭਾਈਚਾਰਕ ਸੈਰ ਸਪਸਟਾਂ ਨੂੰ ਵਧਾਉਣ ਲਈ ਜੋ ਕਿ ਜਿਵੇਂ ਕਿ ਸ਼ਿਮਲਾ ਸਾਈਡ ਬਹੁਤ ਠੰਢਾ ਮੌਹਅ ਹੁੰਦਾ ਏ ਗਰਮੀਆਂ ਵਿੱਚ ਜਿਹੜਾ ਉੱਥੇ ਦਾ ਮੌਸਮ ਫਿਰ ਵੀ ਠੰਡਾ ਹੁੰਦਾ ਏ ਅਤੇ ਜਿਹੜਾ ਇੱਧਰ ਸਰਦੀਆਂ ਵਿੱਚ ਜਿਵੇਂ ਕਿਤੇ ਹੋਰ ਚਲੇ ਜਾਓ ਜਿਵੇਂ ਅ ਇੱਥੇ ਇੱਥੇ ਵੈਸ਼ਨੋ ਦੇਵੀ ਉੱਥੇ ਵੀ ਬਹੁਤ ਠੰਡਾ ਮੌਸਮ ਹੁੰਦਾ ਏ ਗਰਮੀਆਂ ਦੇ ਗਰਮੀਆਂ ਵਿੱਚ ਕੁੱਲੂ ਮਨਾਲੀ ਬਹੁਤ ਵਧੀਆ ਰਹਿੰਦਾ